ਸਤਿ ਸ਼੍ਰੀ ਅਕਾਲ ਜੀ ਉਂਝ ਤਾਂ ਮੇਰੇ ਬਹੁਤ ਸਾਰੇ ਮਿਠਾਈ ਅਤੇ ਪੇਸਟੀ ਫੇਵਰੇਟ ਹਨ ਬਟ ਬਟ ਮੈਂ ਤੁਹਾਨੂੰ ਆਪਣੇ ਪੰਜ ਮਿਠਾਈਆਂ ਦੇ ਨਾਮ ਦੱਸਣ ਜਾ ਰਿਹਾ ਹਾਂ ਮਿਲਕ ਕੇਕ ਬਰਫੀ ਰਸ ਮਲਾਈ ਰ ਰਸਗੁੱਲੇ ਗੁਲਾਬ ਜਾਮੁਨ